ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਵਧੀਆ ਹਾਂਜੀ ਸਭ ਵਧੀਆ ਵਧੀਆ ਜੀ ਬਸ ਬਸ ਫਰੀ ਸੀਗੇ ਦੱਸੋ ਬਸ ਕੁਛ ਨਹੀਂ ਫਰੀ ਹੈ ਦੱਸੋ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਕੂਲ ਤਾਂ ਆਪਣੇ ਇੱਥੇ ਸਾਰੇ ਕਾਫੀ ਸਾਰੇ ਹੈਗੇ ਵਧੀਆ ਇੱਕ ਜਿਵੇਂ ਡੇਰਾ ਭਾਈ ਮਸਤਾਨ ਹੈ ਉਹ ਵੀ ਕਾਫੀ ਅੱਛਾ ਸਕੂਲ ਵਿੱਚ ਹਾਂਜੀ ਉਹਦੇ 'ਚ ਕਾਫੀ ਸਟੱਡੀ ਹਾਈ ਲੈਵਲ ਦੀ ਹੈ ਵਧੀਆ ਬੱਚਿਆਂ ਨੂੰ ਵੀ ਵਧੀਆ ਗਾਈਡ ਵਗੈਰਾ ਕੀਤਾ ਜਾਂਦਾ ਹਾਂਜੀ ਅਤੇ ਇੱਕ ਨਾਲ ਹੀ ਅਕਾਲ ਅਕੈਡਮੀ ਵੀ ਹੈ ਇੱਕ ਆਪਣਾ ਡੀ ਏ ਵੀ ਸਕੂਲ ਹੈਗਾ ਉਹਦੇ 'ਚ ਵੀ ਉਹ ਵੀ ਕਾਫੀ ਵਧੀਆ ਬੱਚਿਆਂ ਲਈ ਕਾਫੀ ਹਾਂਜੀ ਕੁੜੀਆਂ ਵਾਸਤੇ ਕੁੜੀਆਂ ਵਾਸਤੇ ਆਪਣਾ ਹੈਗਾ ਇੱਥੇ ਕੰਨਿਆ ਸਕੂਲ ਹੈਗਾ ਸਰਕਾਰੀ ਉਹਦੇ 'ਚ ਤਾਂ ਦੇਖੋ ਸਹੂਲਤਾਂ ਵੀ ਕਾਫੀ ਹੈ ਬੱਚਿਆਂ ਲਈ ਕਿਉਂਕਿ ਬੱਚਿਆਂ ਨੂੰ ਸਮੇਂ ਸਮੇਂ 'ਤੇ ਜਿਵੇਂ ਜੇ ਕੋਈ ਠੀਕ ਠੀਕ ਹੈ ਮੰਨ ਲਓ ਨਹੀਂ ਖਰਚਾ ਅਫੋਡ ਕਰ ਸਕਦੇ ਅਤੇ ਡਰੈਸ ਵਗੈਰਾ ਵੀ ਟੀਚਰ ਵਗੈਰਾ ਦਿੰਦੇ ਰਹਿੰਦੇ ਹੈ ਜ਼ਰੂਰਤ ਦਾ ਸਾਰਾ ਸਮਾਨ ਦਿੰਦੇ ਰਹਿੰਦੇ ਹੈ ਜਾਂ ਵੈਸੇ ਵੀ ਸਹੂਲਤਾਂ ਕਾਫੀ ਵਜ਼ੀਫੇ ਵਗੈਰਾ ਆਉਂਦੇ ਹੈ ਅੱਜ ਕੱਲ੍ਹ ਤਾਂ ਬਹੁਤ ਸਹੂਲਤਾਂ ਅਤੇ ਸਟਡੀ ਵੀ ਬਹੁਤ ਵਧੀਆ ਪ੍ਰਾਈਵੇਟ ਸਕੂਲਾਂ ਨਾਲੋਂ ਸਗੋਂ ਜ਼ਿਆਦਾ ਵਧੀਆ ਸਟੱਡੀ ਖਾਣੇ ਦਾ ਹਾਂਜੀ ਖਾਣੇ ਦਾ ਵੀ ਸਾਰਾ ਪ੍ਰਬੰਧ ਵਧੀਆ ਆ ਅਤੇ ਸਟਡੀ ਵੀ ਕਾਫੀ ਵਧੀਆ ਬੱਚਿਆਂ ਦੀ ਗਾਈਡੈਂਸ ਵੀ ਵਧੀਆ ਬੱਚਿਆਂ ਨੂੰ ਗਾਈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਕੂਲਾਂ ਦੀ ਵਧੀਆ ਪੜ੍ਹਾਈ ਹੈ ਕਿਉਂਕਿ ਮੇਰੇ ਹਸਬੈਂਡ ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਨਹੀਂ ਸਾਰਾ ਵਧੀਆ ਹਾਂਜੀ ਵਧੀਆ ਵਧੀਆ ਪੜ੍ਹਾਈ ਕਿਉਂਕਿ ਮੇਰੇ ਹਸਬੈਂਡ ਖੁਦ ਟੀ ਟੀਚਰ ਹੈ ਨਾ ਤਾਂ ਮੈਨੂੰ ਖੁਦ ਨੂੰ ਪਤਾ ਵੀ ਵਾਕਿਆ ਸਟਡੀ ਬਹੁਤ ਵਧੀਆ ਹੁੰਦੀ ਆ ਸਕੂਲਾਂ 'ਚ ਹਾਂਜੀ ਬਾਕੀ ਤੁਸੀਂ ਆਪਣਾ ਦੇਖ ਲਿਓ ਜੀ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖੋ ਪ੍ਰਾਈਵੇਟ ਵੀ ਮੈਂ ਤੁਹਾਨੂੰ ਤਿੰਨ ਚਾਰ ਸਕੂਲ ਦੱਸ ਤੇ ਹਾਂਜੀ ਹਾਂਜੀ ਉਹਦੇ 'ਚ ਕਰਾਂ ਦਿਓ ਹਾਂ ਕਿਉਂਕਿ ਇੱਥੇ ਸੁਵਿਧਾ ਵਗੈਰਾ ਵੀ ਆਉਣ ਜਾਣ ਦੀ ਵੀ ਹੈਗੀ ਆ ਕਾਫੀ ਕੁਛ ਤਾਂ ਆਪਣੇ ਏਰੀਏ 'ਚ ਵੀ ਬੱਚੇ ਕਾਫੀ ਜਾਂਦੇ ਆ ਉੱਧਰ ਕੁੜੀਆਂ ਜਾਂਦੀਆਂ ਬਾਕੀ ਵ ਵੈਨ ਵਗੈਰਾ ਵੀ ਲੱਗੀ ਹੋਈ ਆ ਅਤੇ ਔਨ ਦੀ ਰੋ ਔਨ ਦੀ ਰੋਡ ਸਕੂਲ ਹੈਗਾ ਤੇ ਕੋਈ ਐਂ ਬੱਚੇ ਨੂੰ ਵੀ ਦਿੰ ਆਪ ਜੇ ਖੁਦ ਵੀ ਬੱਚਾ ਸਾਈਕਲ ਵਗੈਰਾ 'ਤੇ ਜਾਂਦਾ ਤਾਂ ਜਾਣ ਦੀ ਦਿੱਕਤ ਹੈ ਨਹੀਂ ਗੀ ਹਾਂ ਮੇਨ ਤਾਂ ਆਪਾਂ ਨੂੰ ਇਹ ਹੀ ਹੁੰਦਾ ਵੀ ਬੱਚੇ ਨੂੰ ਇੱਕ ਜਾਣ ਆਉਣ ਦੀ ਵੀ ਦਿੱਕਤ ਨਾ ਹੋਵੇ ਵੀ ਚਲੋ ਸਕੂਲ ਇਹੋ ਜਿਹੀ ਜਗ੍ਹਾ 'ਤੇ ਹੋਵੇ ਹੈ ਨਾ ਅਤੇ ਉਹ ਉਹ ਵੀ ਸਹੂਲਤ ਵਧੀਆ ਉੱਥੇ ਅਤੇ ਉਵੇਂ ਤੁਸੀਂ ਆਪਣੀ ਬਾਕੀ ਤੁਸੀਂ ਆਪਣੀ ਸੈਟਿੰਗ ਦੇਖ ਲਿਓ ਜੇ ਤੁਸੀਂ ਪ੍ਰਾਈਵੇਟ 'ਚ ਲਗਾਉਣਾ ਜਾਂ ਕੋਈ ਗੋਰਮੈਂਟ ਸਕੂਲ 'ਚ ਲਗਾਉਣਾ ਉਹ ਤੁਸੀਂ ਆਪਣਾ ਘਰ ਹੈ ਨਾ ਸਲਾਹ ਕਰਕੇ ਅਤੇ ਫਿਰ ਦੇਖ ਲਿਓ ਬਾਕੀ ਹਾਂਜੀ ਹਾਂ ਹਾਂਜੀ ਹਾਂਜੀ ਬਾਕੀ ਦੇਖ ਲਓ ਆਪਣਾ ਐਂ ਦੇਖ ਲਿਓ ਵੀ ਆਉਣ ਜਾਣਾ ਵੀ ਬੱਚੇ ਨੂੰ ਔਖਾ ਨਾ ਲੱਗੇ ਕੁਛ ਆਪਾਂ ਇਹ ਵੀ ਸੋਚ ਲੈਂਦੇ ਵੀ ਦੂਰ ਨਾ ਹੋਵੇ ਸਕੂਲ ਹੁਣ ਸਕੂਲ ਤਾਂ ਬਹੁਤ ਵਧੀਆ ਪਰ ਥੋੜ੍ਹੇ ਦੂਰ ਵੀ ਪੈਂਦੇ ਆ ਇਹ ਮੈਂ ਤੁਹਾਨੂੰ ਨੇੜੇ ਨੇੜੇ ਵਾਲੇ ਦੱਸ ਤੇ ਵੀ ਆਪਾਂ ਨੂੰ ਨੇੜੇ ਨੇੜੇ ਆ ਬੱਚੇ ਨੂੰ ਵੱਧ ਤੋਂ ਵੱਧ ਟਾਈਮ ਦਸ ਮਿੰਟ ਲੱਗਦੇ ਜਾਣ ਦੇ ਹੈ ਨਾ ਹਾਂਜੀ ਹਾਂ ਜੀ ਓਕੇ ਹਾਂਜੀ ਠੀਕ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ